ਵਾਤਾਵਰਣ ਉਹ ਹੈ ਜੋ ਸਾਡੇ ਚਾਰੇ ਪਾਸੇ ਫੈਲਿਆ ਹੋਇਆ ਹੈ ਇਸ ਦੇ ਵਿੱਚ ਸਾਡੇ ਆਲੇ ਦੁਆਲੇ ਦੀ ਸਥਿਤੀ ਮਨੁੱਖ ਜੀਵ ਜੰਤੂ ਪੇੜ ਪੌਦੇ ਸਾਰੀ ਕੁਦਰਤ ਪ੍ਰਕ੍ਰਿਤੀ ਹਵਾ ਪਾਣੀ ਮਿੱਟੀ ਸ਼ਾਮਿਲ ਹਨ ਵਾਤਾਵਰਣ ਸਾਹਮਣੇ ਅੱਜ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਜਿਵੇਂ ਕਿ ਸਭ ਤੋਂ ਵੱਡੀ ਸਮੱਸਿਆ ਪ੍ਰਦੂਸ਼ਣ ਦੀ ਹੈ ਜਲ ਪ੍ਰਦੂਸ਼ਣ ਹੋ ਰਿਹਾ ਹੈ ਹਵਾ ਪ੍ਰਦੂਸ਼ਣ ਹੋ ਰਿਹਾ ਹੈ ਭੂਮੀ ਪ੍ਰਦੂਸ਼ਣ ਹੋ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਹੀ ਵਾਤਾਵਰਣ ਦੀ ਜਿਹੜੀ ਸ਼ੁੱਧਤਾ ਨੂੰ ਵੀ ਅੱਜ ਖਤਰਾ ਹੈ ਕਈ ਤਰ੍ਹਾਂ ਦੀਆਂ ਗੈਸਾਂ ਹਨ ਜਿਹੜੀਆਂ ਕਿ ਵਾਤਾਵਰਨ ਨੂੰ ਅਸ਼ੁੱਧ ਕਰ ਰਹੀਆਂ ਹਨ ਫੈਕਟਰੀਆਂ ਕਾਰਖਾਨਿਆਂ ਉਦਯੋਗਾਂ ਵਿਚੋਂ ਧੂੰਆਂ ਨਿਕਲ ਰਿਹਾ ਹੈ ਜਿਸ ਨਾਲ ਸਾਡਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਨਦੀਆਂ ਦਾ ਪਾਣੀ ਵੀ ਜਿਹੜਾ ਹੈ ਖਰਾਬ ਹੋ ਰਿਹਾ ਹੈ ਜਿਵੇਂ ਕਈ ਤਰ੍ਹਾਂ ਦੇ ਮਲ ਮੂਤਰ ਫਾਲਤੂ ਪਦਾਰਥ ਪਾਣੀ ਵਿੱਚ ਜਾ ਰਹੇ ਹਨ ਜਿਸ ਕਾਰਨ ਨਦੀਆਂ ਦਾ ਪਾਣੀ ਖਰਾਬ ਹੋ ਰਿਹਾ ਵਣਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ ਅਤੇ ਖੇਤਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਅਸੀਂ ਰਸਾਇਣ ਪਾਉਂਦੇ ਹਾਂ ਜਿਸ ਕਾਰਨ ਕਿ ਭੂ ਖੋਰ ਵਗੈਰਾ ਵੀ ਹੋ ਜਾਂਦਾ ਹੈ ਅਤੇ ਜਿਹੜੀ ਖੇਤਾਂ ਦੀ ਉਪਜਾਊ ਸ਼ਕਤੀ ਹੈ ਉਹ ਵੀ ਇਸ ਨਾਲ ਘੱਟ ਜਾਂਦੀ ਹੈ ਰੁੱਤਾਂ ਦੇ ਵਿੱਚ ਵੀ ਪਰਿਵਰਤਨ ਹੋ ਰਿਹਾ ਹੈ ਗਰਮੀ ਦੇ ਮੌਸਮ ਵਿੱਚ ਜ਼ਰੂਰਤ ਤੋਂ ਅਧਿਕ ਤਾਪਮਾਨ ਰਹਿੰਦਾ ਹੈ ਅਤੇ ਸਰਦੀ ਵੀ ਅਧਿਕ ਪੈਂਦੀ ਹੈ